ਸਾਡੇ ਪੰਜਾਬ ਵਿੱਚ ਮੈਂ ਰਹਿੰਦਾ ਹਾਂ ਅੰਮ੍ਰਿਤਸਰ ਵਿੱਚ ਸਾਡੇ ਅੰਮ੍ਰਿਤਸਰ ਵਿੱਚ ਕਾਫੀ ਅਲੱਗ ਅਲੱਗ ਸੈਰ ਕਰਨ ਦੀਆਂ ਘੁੰਮਣ ਦੀਆਂ ਥਾਂਵਾਂ ਨੇ ਜਿਸ ਤਰ੍ਹਾਂ ਕਿ ਹੁਣ ਸਾਡੇ ਇੱਥੇ ਗੋਲਡਨ ਟੈਂਪਲ ਹੈ ਇੱਕ ਧਾਰਮਿਕ ਸਥਾਨ ਹੈ ਜਿੱਥੇ ਕਾਫੀ ਲੋਕ ਬਾਹਰੋਂ ਆਉਂਦੇ ਨੇ ਵੇਖਣ ਕਾਫੀ ਟੂਰਿਜ਼ਮ ਹੁੰਦਾ ਇੱਥੇ ਆਪਾਂ ਵੀ ਰੋਜ਼ ਜਾਈਦਾ ਮੱਥਾ ਟੇਕੀਦਾ ਅਤੇ ਕਾਫੀ ਅੱਛਾ ਲੱਗਦਾ ਉਥੇ ਜਾ ਕੇ ਉੱਥੇ ਕਾਫੀ ਵੱਡਾ ਬਣਿਆ ਅਤੇ ਕਾਫ਼ੀ ਘੁੰਮਣ ਦੀ ਜਗ੍ਹਾ ਹੈਗੀ ਹੈ ਉਹ ਤੋਂ ਇਲਾਵਾ ਜੇ ਗੱਲ ਕਰੀਏ ਜੇ ਆਪਾਂ ਜਿੱਥੇ ਕੰਪਨੀ ਬਾਗ਼ ਏ ਕੰਪਨੀ ਬਾਗ਼ ਲੋਕ ਸਵੇਰੇ ਸਵੇਰੇ ਆਪਣੀ ਮਤਲਬ ਕਿ ਸੈਰਾਂ ਕਰਨ ਜਾਂਦੇ ਹਨ ਉੱਥੇ ਕਾਫੀ ਮਸ਼ੀਨਾਂ ਲੱਗੀਆਂ ਜਿੱਥੇ ਕਿ ਲੋਕੀ ਕਸਰਤ ਕਰਦੇ ਹਨ ਕਾਫੀ ਚੀਜ਼ਾਂ ਨੇ ਜੋ ਖਾਂਦੇ ਨੇ ਜੋ ਲੋਕਾਂ ਦੀ ਸਿਹਤ ਵਾਸਤੇ ਅੱਛੀ ਹੈਗੀਆਂ ਪੰਜਾਬ ਵਿੱਚ ਹੋਰ ਵੀ ਕਈ ਥਾਂਵਾਂ ਨੇ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰੀਏ ਦੁਰਗਿਆਣਾ ਮੰਦਰ ਜਿੱਥੇ ਮੰਦਰ ਵਿੱਚ ਵੀ ਆਪਾਂ ਜਾਈਏ ਅਤੇ ਆਪਾਂ ਉਥੇ ਕਾਫੀ ਰਿਲੈਕਸ ਫੀਲ ਕਰਦੇ ਹਨ ਪੰਜਾਬ ਵਿੱਚ ਕਾਫੀ ਵਧੀਆ ਵਧੀਆ ਘੁੰਮਣ ਦੀਆਂ ਥਾਂਵਾਂ ਹੈਗੀਆ ਹਨ ਹਰ ਥਾਂ ਵਿੱਚ ਤੁਹਾਨੂੰ ਅਲੱਗ ਹੀ ਇਕ ਵੱਖਰੀ ਵਾਈਵ ਆਏਗੀ ਕਿਉਂਕਿ ਹਰ ਥਾਂ ਵਿੱਚ ਆਪਣਾ ਇੱਕ ਅਲੱਗ ਚੀਜ਼ ਹੈ ਹੁਣ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਗੋਲਡਨ ਟੈਂਪਲ ਗੋਲਡਨ ਟੈਂਪਲ ਵਿੱਚ ਧਾਰਮਿਕ ਅਸਥਾਨ ਹੈ ਇੱਕ ਤਾਂ ਉੱਥੇ ਲੋਕੀ ਬਾਹਰੋਂ ਬਹੁਤ ਆਉਂਦੇ ਹਨ ਅਤੇ ਇੱਥੇ ਉਹ ਬਾਹਰੋਂ ਤਾਂ ਆਉਂਦੇ ਹਨ ਅਤੇ ਇੱਥੋਂ ਵੀ ਕਾਫੀ ਲੋਕ ਜਿਹੜੇ ਹੈਗੇ ਹਨ ਰੋਜ਼ ਮਤਲਬ ਕਿ ਜ ਜਿਸ ਟਾਈਮ ਮਰਜ਼ੀ ਚੱਲ ਜਾਓ ਤੁਸੀਂ ਉੱਥੇ ਭੀੜ ਹੋਏਗੀ ਤੁਹਾਨੂੰ ਜਿਸ ਟਾਈਮ ਮਤਲਬ ਕਿ ਰਾਤੀ ਬਾਰਾਂ ਵਜੇ ਚੱਲ ਜਾਓ ਦੋ ਵਜੇ ਚੱਲ ਜਾਓ ਤਿੰਨ ਵਜੇ ਚੱਲ ਜਾਓ ਚਾਰ ਵਜੇ ਚੱਲ ਜਾਓ ਉੱਥੇ ਭੀੜ ਹੁੰਦੀ ਹੀ ਹੁੰਦੀ ਹੈ ਕਿਉਂਕਿ ਉਹ ਇੱਕ ਧਾਰਮਿਕ ਸਥਾਨ ਹੈ ਇਸ ਅੰਮ੍ਰਿਤਸਰ ਦਾ ਅੰਮ੍ਰਿਤਸਰ ਵਿੱਚ ਉਹ ਸਭ ਤੋਂ ਨੰਬਰ ਵਨ ਚੀ ਹੈਗੀ ਜਗ੍ਹਾ ਹੈਗੀ ਹੈ ਜਿੱਥੇ ਲੋਕੀ ਆਪਣਾ ਰੀਲੈਕਸ ਹੋਣ ਜਾਂਦੇ ਹਨ ਸੈਰ ਕਰਨ ਜਾਂਦੇ ਹਨ ਉਹਦੇ ਆਲੇ ਦੁਆਲੇ ਸ਼ਹੀਦਾਂ ਸਾਹਿਬ ਗੱਲ ਕਰੀਏ ਸ਼ਹੀਦਾਂ ਸਾਹਿਬ ਵੀ ਲੋਕੀ ਕਿੰਨਾ ਅੱਜ ਕੱਲ੍ਹ ਚੁਪਹਿਰਾ ਲੱਗਣ ਡਿਆ ਚੁਪਹਿਰੇ ਵਿੱਚ ਲੋਕ ਸ਼ਨੀਵਾਰ ਐਤਵਾਰ ਰੋਜ਼ ਆਉਂਦੇ ਹਨ ਅਤੇ ਆਪਣਾ ਚੁਪਹਿਰਾ ਕੱਟਦੇ ਹਨ ਅਤੇ ਵਾਪਸ ਚੱਲ ਜਾਂਦੇ ਹਨ ਪਿੰਡ ਆਪਣੇ ਪਿੰਡ ਤੋਂ ਆਏ ਹੁੰਦੇ ਪਿੰਡ ਚੱਲ ਜਾਂਦੇ ਹਨ ਜਿਹੜੇ ਲੋਕੀ ਜਿੱਥੋਂ ਆਏ ਹੁੰਦੇ ਨੇ ਉੱਥੇ ਚੱਲ ਜਾਂਦੇ ਹਨ ਇਹ ਇੱਕ ਕਾਫੀ ਵੱਖਰੀ ਜਿਹੀ ਚੀਜ਼ ਆ ਸਾਡੇ ਅੰਮ੍ਰਿਤਸਰ ਵਿੱਚ